ਪੰਜਾਬੀ ਭਾਸ਼ਾ ਬਹੁਤ ਹੀ ਪਿਆਰੀ ਸੋਹਣੀ ਅਤੇ ਅਣਮੁੱਲੀ ਭਾਸ਼ਾ ਹੈ ਇਹ ਸਾਨੂੰ ਸਾਡੇ ਗੁਰੂਆਂ ਦੁਆਰਾ ਬਖਸ਼ੀ ਹੋਈ ਦਾਤ ਹੈ ਪੰਜਾਬੀ ਭਾਸ਼ਾ ਦੀ ਸਿਰਜਣਾ ਸਾਡੇ ਗੁਰੂਆਂ ਦੁਆਰਾ ਕੀਤੀ ਗਈ ਹੈ ਪੰਜਾਬੀ ਭਾਸ਼ਾ ਦੇ ਬਹੁਤ ਹੀ ਜ਼ਿਆਦਾ ਸ਼ਬਦ ਸਾਨੂੰ ਗੁਰਮੁਖੀ ਵਿੱਚੋਂ ਮਿਲਦੇ ਹਨ ਇਹ ਪੰਜਾਬੀ ਭਾਸ਼ਾ ਗੁਰਮੁਖੀ ਨਾਲ ਬਹੁਤ ਹੱਦ ਤੱਕ ਮੇਲ ਖਾਂਦੀ ਹੈ ਪੰਜਾਬ ਵਿੱਚ ਚਾਰ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ ਮਾਝੀ ਮਲਵਈ ਦੋਆਬੀ ਅਤੇ ਪੁਆਧੀ ਜੋ ਕਿ ਪੰਜਾਬੀ ਭਾਸ਼ਾ ਦੇ ਹੀ ਅੰਸ਼ ਹਨ ਅਤੇ ਇਹ ਪੰਜਾਬੀ ਭਾਸ਼ਾ ਅੱਜ ਅੱਜ ਦੇ ਟਾਈਮ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਚੁੱਕੀ ਹੈ ਅਤੇ ਸਾਰੀ ਦੁਨੀਆਂ ਵਿੱਚ ਰਾਜ ਕਰ ਰਹੀ ਹੈ ਪੰਜਾਬੀ ਭਾਸ਼ਾ ਦੇ ਬਹੁਤ ਹੀ ਸਹਿ ਸਾਹਿਤਕਾਰਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਉੱਚੇ ਸਤਰ ਤੱਕ ਲੈ ਕੇ ਗਏ ਹਨ ਅਤੇ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਸਾਡੇ ਗੁਰੂਆਂ ਪੀਰਾਂ ਨੇ ਗੁਰਬਾਣੀ ਵਿੱਚ ਗੁਰਮੁਖੀ ਦੇ ਤੌਰ 'ਤੇ ਦਰਜ ਕੀਤਾ ਹੈ ਅਤੇ ਅਸੀਂ ਜਦੋਂ ਵੀ ਗੁਰਬਾਣੀ ਦੇ ਅਰਥ ਕੱਢਦੇ ਹਨ ਅਤੇ ਉਹ ਅਰਥ ਸਾਨੂੰ ਪੰਜਾਬੀ ਵਿੱਚ ਹੀ ਮਿਲਦੇ ਹਨ